ਮੈਂ ਰਾਜਨੀਤਿਕ ਸ਼ਾਸ਼ਤਰ ਵਿਚ ਵਿਧਿਆਰਥਣ ਹਾਂ ਅਤੇ ਮੇਰਾ ਇਹ ਸਬਜੈਕਟ ਨੂੰ ਰੱਖਣ ਦਾ ਕਾਰਣ ਇਹ ਹੀ ਸੀ ਕਿ ਮੈਂ ਕਾਨੂੰਨ ਅਤੇ ਦੇਸ਼ ਪ੍ਰਤੀ ਸਰਕਾਰ ਪ੍ਰਤੀ ਸੁਚੇਤ ਰਹਾਂ ਅਤੇ ਮੈਂ ਉਹਨਾਂ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹ ਸਕਾਂ ਅਤੇ ਉਹਨਾਂ ਵਿੱਚ ਆਪਣਾ ਯੋਗਦਾਨ ਪਾ ਸਕਾਂ ਮੈਂ ਮੌਜੂਦਾ ਖ਼ਬਰਾਂ ਪ੍ਰਤੀ ਬਹੁਤ ਹੀ ਦਿਲਚਸਪੀ ਲੈਂਦੀ ਹਾਂ ਮੇਰੀ ਦਿਨ ਦੀ ਸ਼ੁਰੂਆਤ ਹਮੇਸ਼ਾ ਅਖ਼ਬਾਰ ਪੜ੍ਹ ਕੇ ਜਾ ਖ਼ਬਰਾਂ ਦੇਖ ਕੇ ਹੁੰਦੀ ਹੈ ਤਾਂ ਜੋ ਮੈਂ ਉਹਨਾਂ ਖ਼ਬਰਾਂ ਤੋਂ ਕੁਛ ਸਿੱਖ ਸਕਾਂ ਅਤੇ ਮੈਂ ਸਮਝ ਸਕਾਂ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਉਹ ਕੀ ਕਰ ਰਹੀ ਹੈ ਮੈਂ ਅੱਜ ਦੇ ਸਮੇਂ ਵਿੱਚ ਇਹ ਦੇਖ ਕੇ ਬਹੁਤ ਦੁਖੀ ਹਾਂ ਕਿ ਸਰਕਾਰ ਦੇਸ਼ ਪ੍ਰਤੀ ਅਤੇ ਦੇਸ਼ ਦੇ ਕੰਮਾਂ ਪ੍ਰਤੀ ਉੰਨੀਂ ਸੀਰੀਅਸ ਨਹੀਂ ਐ ਜਿੰਨੀ ਕਿ ਉਹਨੂੰ ਹੋਣਾ ਚਾਹੀਦਾ ਹੈ